ਜਿਹੜਾ ਕੁਕਿੰਗ ਕਰਨਾ ਉਹ ਮੇਰਾ ਸ਼ੌਕ ਹੈ ਮੈਂ ਰੋਜ਼ਾਨਾ ਜ਼ਿੰਦਗੀ ਵਿੱਚ ਕੁਛ ਨਾ ਕੁਛ ਰੋਜ਼ ਨਵਾਂ ਤਿਆਰ ਕਰਦੀ ਰਹਿੰਦੀ ਹਾਂ ਪਰ ਕੁਝ ਕੁ ਮਤਲਬ ਇੱਕ ਮਹੀਨੇ ਤੋਂ ਥੋੜ੍ਹਾ ਜਿਹਾ ਮੈਂ ਕੁਕਿੰਗ ਵੱਲ ਧਿਆਨ ਥੋੜ੍ਹਾ ਘੱਟ ਦੇ ਪਾ ਰਹੀ ਹਾਂ ਕਿਉਂਕਿ ਮੇਰੇ ਕੁਝ ਹੋਰ ਰੁਝਾਨ ਜ਼ਿਆਦਾ ਚੱਲ ਰਹੇ ਨੇ ਪਰ ਮੈਂ ਕੁਕਿੰਗ ਭੁੱਲੀ ਨਹੀਂ ਹਾਂ ਮਤਲਬ ਮੈਂ ਆਪਣਾ ਜਿਹੜਾ ਸਭ ਤੋਂ ਈਜ਼ੀ ਅਤੇ ਸਭ ਤੋਂ ਵਧੀਆ ਰੈਸਿਪੀ ਸ਼ੇਅਰ ਕਰਾਂਗੀ ਤੁਹਾਡੇ ਨਾਲ ਕਿਉਂਕਿ ਜਿਹੜੇ ਬੱਚੇ ਨੇ ਉਹ ਜਦੋਂ ਕੋਈ ਸਬਜ਼ੀ ਵਗੈਰਾ ਨਹੀਂ ਹੁੰਦੀ ਘਰ ਦੇ ਵਿੱਚ ਤਾਂ ਯੂਜਅਲੀ ਇਹੀ ਉਹ ਕਹਿੰਦੇ ਨੇ ਕਿ ਮੰਮਾ ਜੀ ਮੈਗੀ ਬਣਾ ਦਿਉ ਅਤੇ ਆਮ ਤੌਰ 'ਤੇ ਜਿਹਨਾਂ ਨੂੰ ਜ਼ਿਆਦਾ ਸ਼ੌਂਕ ਨਹੀਂ ਹੁੰਦਾ ਕੁਕਿੰਗ ਦਾ ਉਹ ਨੋਰਮਲ ਜਿਹੀ ਮੈਗੀ ਬਣਾ ਕੇ ਨਾ ਬੱਚਿਆਂ ਨੂੰ ਖਿਲਾ ਦਿੰਦੇ ਹਾਂ ਪਰ ਮੈਂ ਜਿਹੜੀ ਮੈਗੀ ਤਿਆਰ ਕਰਨ ਦਾ ਤਰੀਕਾ ਦੱਸਾਂਗੀ ਉਹ ਮੈਗੀ ਇੰਨੀ ਸਵਾਦ ਅਤੇ ਇੰਨੀ ਅਲੱਗ ਲੱਗਦੀ ਹੈ ਉਹ ਲੱਗਦਾ ਹੀ ਨਹੀਂ ਕਿ ਮੈਗੀ ਹੈ ਪਹਿਲੇ ਮੈਗੀ 'ਚ ਬਟਰ ਪਾ ਲਉ ਮੱਖਣ ਜਿਹਨੂੰ ਆਪਾਂ ਕਹਿੰਦੇ ਹਾਂ ਤੁਸੀਂ ਇੱਕ ਸਲਾਈਸ ਮੋਟੀ ਬ ਮੱਖਣ ਦੀ ਪਾ ਕੇ ਉਹਦੇ ਵਿੱਚ ਜਿਹੜਾ ਲੱਸਣ ਹੁੰਦਾ ਉਹਦੇ ਚਾਰ ਪੰਜ ਤੁਸੀਂ ਚਾਰ ਪੰਜ ਪੀਸਿਸ ਕੱਟ ਕੇ ਉਹਨੂੰ ਤੁਸੀਂ ਕੱਦੂਕਸ ਕਰਕੇ ਲਸਣ ਨੂੰ ਉਸਦੇ ਵਿੱਚ ਪਾ ਦਿਉ ਅਤੇ ਉਹ ਜਿਹੜੀ ਖਸ਼ਬੂ ਉਠੇਗੀ ਉਹ ਤੁਹਾਡਾ ਬੱਚਾ ਖੁਦ ਹੀ ਕਹੇਗਾ ਵੀ ਮੰਮੀ ਅੱਜ ਤੁਸੀਂ ਬਹੁਤ ਕੁਛ ਵਧੀਆ ਬਣਾ ਰਹੇ ਹੋ ਜਾਂ ਮੰਮੀ ਜਾਂ ਦੀਦੀ ਅਤੇ ਉਹਦੇ ਵਿੱਚ ਫਿਰ ਤੁਸੀਂ ਅਦ ਲਸਣ ਪਾ ਲੈਣਾ ਅਦਰਕ ਨਹੀਂ ਪਾਉਣਾ ਇਕੱਲਾ ਲਸਣ ਨੂੰ ਤੁਸੀਂ ਥੋੜ੍ਹਾ ਜਿਹਾ ਬਰਾਉਨ ਜਿਹਾ ਹੋ ਜਾਂਦਾ ਉਦੋਂ ਤੱਕ ਉਸਨੂੰ ਭੁੰਨਣਾ ਹੈਗਾ ਮੱਖਣ ਦੇ ਵਿੱਚ ਤੇਲ ਦੇ ਵਿੱਚ ਨਹੀਂ ਮੱਖਣ ਵਿੱਚ ਅਤੇ ਫਿਰ ਉਸ ਤੋਂ ਬਾਅਦ ਤੁਸੀਂ ਜਿਹੜੀ ਵੀ ਆਪਣੀ ਸਬਜ਼ੀਆ ਪਾਉਣਾ ਚਾਹੁੰਦੇ ਹੋ ਜਿਵੇਂ ਕਿ ਸਵੀਟ ਕੋਰਨ ਸ਼ਿਮਲਾ ਮਿਰਚ ਪਿਆਜ ਟਮਾਟਰ ਇਹ ਸਾਰਾ ਕੁਛ ਪਾ ਕੇ ਤੁਸੀਂ ਉਸਨੂੰ ਤੜਕਾ ਲਾ ਲਉ ਤੜਕਾ ਲਾ ਕੇ ਫਿਰ ਤੁਸੀਂ ਉਹਦੇ ਉੱਤੇ ਔਰੀਗੈਨੋ ਅਤੇ ਚਿਲੀ ਫਲਿਕਸ ਜਿਹੜੇ ਕਿ ਬੱਚੇ ਬਾਹਰ ਖਾਣ ਜਾਂਦੇ ਨੇ ਪੀਜ਼ੇ ਦੇ ਉੱਤੇ ਪਾ ਪਾ ਕੇ ਅਤੇ ਉਹ ਤੁਸੀਂ ਔਰੀਗੈਨੋ ਅਤੇ ਚਿਲੀ ਫਲਿਕਸ ਤੁਸੀਂ ਉਹਦੇ ਵਿੱਚ ਪਾ ਕੇ ਉਸਨੂੰ ਥੋੜ੍ਹਾ ਕਰਾਰਾ ਜਿਹਾ ਬਣਾ ਕੇ ਉਹਦਾ ਤੜਕਾ ਲਾ ਲਉ ਉਸ ਤੋਂ ਬਾਅਦ ਉਹਦੇ ਵਿੱਚ ਫਿਰ ਮੈਗੀ ਨੂੰ ਚੂਰ ਕੇ ਪਾਓ ਫਿਰ ਥੋੜ੍ਹਾ ਜਿਹਾ ਅੱਧਾ ਕੁ ਅੱਧਾ ਪੌਣਾ ਗਲਾਸ ਪਾਣੀ ਤਾਂ ਕਿ ਮੈਗੀ ਜ਼ਿਆਦਾ ਨਾ ਰਿੱਝ ਜੇ ਅੱਧਾ ਪੌਣਾ ਕੁ ਗਿਲਾਸ ਪਾਣੀ ਪਾ ਕੇ ਉਸਨੂੰ ਤੁਸੀਂ ਥੋੜ੍ਹਾ ਜਿਹਾ ਕਾੜ ਲੈਣਾ ਕਾੜ ਕੇ ਫਿਰ ਦੁਬਾਰਾ ਤੁਸੀਂ ਉਹਦੇ ਵਿੱਚ ਮੱਖਣ ਪਾਉਣਾ ਹੈਗਾ ਅਤੇ ਮੱਖਣ ਪਾ ਕੇ ਉਹ ਜਦੋਂ ਉਹਨੂੰ ਢੱਕ ਦੇਣਾ ਗੈਸ ਬੰਦ ਕਰ ਦੇਣੀ ਢੱਕ ਦੇਣਾ ਉਸਨੂੰ ਫਿਰ ਤੁਸੀਂ ਜਦੋਂ ਢੱਕਣ ਹਟਾਓਗੇ ਤਾਂ ਉਹ ਮੈਗੀ ਬਹੁਤ ਜ਼ਿਆਦਾ ਵਧੀਆ ਤਰ੍ਹਾਂ ਤਿਆਰ ਹੋ ਜੇਗੀ ਅਤੇ ਉਹ ਮੈਗੀ ਦਾ ਸਵਾਦ ਅਲ ਸਭ ਮੈਗੀਆਂ ਤੋਂ ਅਲੱਗ ਹੋਏਗਾ ਬਹੁਤ ਜ਼ਿਆਦਾ ਵਧੀਆ ਹੋਏਗਾ ਤਾਂ ਮੈਗੀ ਦੀ ਰੈਸਿਪੀ ਜ਼ਰੂਰ ਟਰਾਈ ਕਰਨੀ ਐ ਜੀ ਧੰਨਵਾਦ ਜੀ